ਹੈਲੋ ਹੈਲੋ ਹਾਂਜੀ ਸਰ ਮੈਨੂੰ ਬੂਟ ਚਾਹੀਦੇ ਜੀ ਹਾਂਜੀ ਬ ਬੂਟ ਚਾਹੀਦੇ ਮਤਲਬ ਤੁਹਾਡੇ ਕੋਲ ਕਿਹੜੀ ਕਿਹੜੀ ਕੌਂਪਨੀ ਦੇ ਬੂਟ ਹੈ ਆਹੋ ਅਲੱਗ ਅਲੱਗ ਕੈਟਾਗਰੀ ਦੱਸੋ ਰੇਟ ਕਿੰਨਾ ਹੈ ਬ੍ਰਾਂਡੇਡ ਦਾ ਰੇਟ ਕੀ ਕਿਹੜੀ ਕਿਹੜੀ ਬ੍ਰੈਂਡ ਹੈ ਹਮ ਹਮ ਮੈਂ ਦੋ ਹਜ਼ਾਰ ਤੱਕ ਲੈਣੇ ਹੈ ਜੀ ਅਤੇ ਕਿਹੜੀ ਕਿਹੜੀ ਕੰਪਨੀ ਦਾ ਆ ਜਾਵੇਗਾ ਦੋ ਹਜ਼ਾਰ ਤੱਕ ਤੁਸੀਂ ਅੱਠ ਨੰਬਰ ਜੀ ਹਮ ਅੱਛਾ ਜੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਕਿਹੜੀ ਕੌਂਪਨੀ ਹੈ ਯਾਨੀ ਕਿ ਤੁਸੀਂ ਕਿੰਨੇ ਬ੍ਰੈਂਡਾਂ ਪਰ ਡਿੰਸਕਾਊਂਟ ਦਿੰਦੇ ਜੀ ਐਡੀਡਸ ਐਡੀਡਸ ਤੁਸੀਂ ਕਿੰਨਾ ਡਿੰਸਕਾਊਂਟ ਦਿੰਦੇ ਹੈ ਅੱਛਾ ਜੀ ਹੋਰ ਹੋਰ ਵਗੈਰਾ ਯਾਨੀ ਜੀ ਹੋਰ ਹੋਰ ਕੌਂਪਨੀ ਦੇ ਕਿੱਦਾਂ ਡਿੰਸਕਾਊਂਟ ਕਿੰਨੇ ਕੋਈ ਘੱਟ ਰੇਟ 'ਤੇ ਕਿੰਨੇ ਹੈ ਜੀ ਹਮ ਹਮ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਠੀ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਮੈ ਦੱਸਿਉ ਅਸੀਂ ਲੈਣੇ ਹੈ ਬੂਟ ਜੀ ਠੀਕ ਹੈ ਠੀਕ ਹੈ ਜੀ ਤੁਹਾਡੀ ਸ਼ੋਪ 'ਚ ਆ ਜਾਂਦੇ ਸ਼ੋਪ ਦਾ ਕ ਨਾਂ ਕੀ ਹੈ ਜੀ ਔਨਲੈਨ ਡਿਲੀਵਰੀ ਕਰ ਦਿੰਦੇ ਜੀ ਚਲੋ ਠੀਕ ਹੈ ਸਰ ਤੁਹਾਡੀ ਸ਼ੋਪ 'ਤੇ ਆਉਂਦੇ ਸ਼ੋਪ 'ਤੇ ਗੱਲ ਕਰਦੇ ਹੈ ਜੀ ਓਕੇ ਜੀ ਓਕੇ ਥੈਂਕ ਥੈਂਕ ਥੈਂਕ ਥੈਂਕ ਯੂ ਭਾਅ ਜੀ